ਹੈਲੋ ਨਮਸਕਾਰ ਮੈਂ ਇੱਥੇ ਪਠਾਨਕੋਟ 'ਚ ਨਵੀਂ ਆਈ ਹਾਂ ਅਤੇ ਮੈਂ ਡੇਅਰੀ ਬਾਰੇ ਪੁੱਛਣਾ ਚਾਹੁੰਦੀ ਹਾਂ ਕਿ ਇੱਥੇ ਦੁੱਧ ਦਹੀਂ ਕਿੱਥੋਂ ਮਿਲ ਜ ਜਾਂਦਾ

ਠੀਕ ਹੈ ਅੱਛਾ

ਠੀਕ ਹੈ